ਜ਼ਿੰਦਗੀ ਦਾ ਨਾਮ ਹੈ ਸਿੱਖਦੇ ਰਹਿਣਾ ਅਤੇ ਜਦੋਂ ਤੱਕ ਆਪਣੇ ਸਾਹ ਚੱਲਦੇ ਹੈ ਆਪਾਂ ਸਿੱਖਦੇ ਹੀ ਰਹਿੰਦੇ ਐਂ ਚਾਹੇ ਉਹ ਇੱਕ ਛੋਟੇ ਜਿਹੇ ਬੱਚੇ ਤੋਂ ਸਿੱਖ ਲਈਏ ਚਾਹੇ ਇੱਕ ਬਜ਼ੁਰਗ ਤੋਂ ਜ਼ਿੰਦਗੀ ਦਾ ਨਾਮ ਹੀ ਸਿੱਖਦੇ ਰਹਿਣਾ ਏ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਅਜਿਹੇ ਪਲ ਆਏ ਹਨ ਇਹੋ ਜਿਹੇ ਕੰਮ ਹੋਏ ਹਨ ਜਿਨ੍ਹਾਂ ਤੋਂ ਮੈਂ ਬਹੁਤ ਜ਼ਿਆਦਾ ਸਬਕ ਲਏ ਹਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਾਂ ਨੂੰ ਕਿਸੇ ਵੀ ਬੰਦੇ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਭਰੋਸਾ ਅੱਖਾਂ ਬੰਦ ਕਰਕੇ ਨਹੀਂ ਕਰਨਾ ਚਾਹੀਦਾ ਅਤੇ ਨੰਬਰ ਦੋ ਕਿਸੇ ਨੂੰ ਵੀ ਆਪਣੇ ਦਿਲ ਦੀ ਗੱਲ ਨਹੀਂ ਦੱਸਣੀ ਚਾਹੀਦੀ ਹੈਗੀ ਕਿਉਂਕਿ ਜਿਹੜੇ ਬੰਦੇ ਨੂੰ ਆਪਾਂ ਆਪਣੇ ਦਿਲ ਦੀ ਗੱਲ ਦੱਸ ਦਿੰਦੇ ਉਹ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਧੋਖਾ ਜ਼ਰੂਰ ਦਿੰਦਾ ਏ ਅਤੇ ਤੁਹਾਡੀ ਉਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਤੁਹਾਨੂੰ ਨੁਕਸਾਨ ਪਹੁੰਚਾਉਦਾ ਏ ਇਸ ਕਰਕੇ ਕਦੇ ਵੀ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸਣੀ ਨਹੀਂ ਚਾਹੀਦੀ ਅਤੇ ਇਹਨਾਂ ਗੱਲਾਂ ਤੋਂ ਸਬਕ ਲੈਣਾ ਚਾਹੀਦਾ ਏ